ਚਰਚਾ ਕਰਦੇ ਹਨ ਨੌਕਰੀ ਅਤੇ ਸਿੱਖਿਆ ਅਤੇ ਜਨਤਕ ਵਿੱਤ ਅਤੇ ਸ਼ਾਸਨ ਅਤੇ ਰਾਜ ਦੁਆਰਾ ਦਰਪੇਸ਼ ਚੁਣੌਤੀਆਂ ਦੇ ਕਾਰਨ ਇਸ ਤੋਂ ਇਲਾਵਾ ਉਹ ਵਿਕਾਸ ਅਤੇ ਸਮਰਥ ਨੀਤੀਆਂ ਦੀਆਂ ਸੰਭਾਵਨਾਵਾਂ 'ਤੇ ਵਿਚਾਰ ਕਰਦੇ ਹਨ ਪੰਜਾਬ ਦੀ ਆਰਥਿਕਤਾ ਹੌਲੀ ਵਿਕਾਸ ਸਮਾਜਿਕ ਚੁਣੌਤੀਆਂ ਅਤੇ ਵਾਤਾਵਰਣ ਦੀ ਵਿਗਾਰਡ ਦੁਆਰਾ ਦਰਸਾਈ ਗਈ ਹੈ ਪੰਜਾਬ ਦੇ ਹਾਲ ਹੀ ਦੇ ਕੁਝ ਆਰਥਿਕ ਚਾਲ ਚਲਣ ਨੂੰ ਇਸਦੇ ਭੂਗੋਲ ਦੁਆਰਾ ਅਕਾਰ ਦਿੱਤਾ ਗਿਆ ਹੈ ਜਿਸ ਵਿੱਚ ਅੰਤਰਰਾਸ਼ਟਰੀ ਸਰਹੱਦ 'ਤੇ ਇਸ ਦੀ ਸਥਿਤੀ ਅਤੇ ਇਸਦੀ ਪਾਣੀ ਦੀ ਉਪਲਬਧਤਾ ਸ਼ਾਮਿਲ ਹੈ ਉੱਨੀ ਸੌ ਸੰਤਾਲੀ ਵਿੱਚ ਖੇਤਰ ਦੀ ਵੰਡ ਕਰਕੇ ਅਤੇ ਫਿਰ ਉੱਨੀ ਸੌ ਛਿਆਹਠ ਵਿੱਚ ਭਾਰਤੀ ਪੰਜਾਬ ਦੀ ਵੰਡ ਕਰਕੇ ਖੇਤੀਬਾੜੀ ਲਈ ਪਾਣੀ ਦੀ ਉਪਲਬਧਤਾ ਸਿਆਸੀ ਤੌਰ 'ਤੇ ਸੀਮਿਤ ਹੋ ਗਈ ਸੀ ਬਾਅਦ ਦੀ ਘਟਨਾ ਰਾਸ਼ਟਰੀ ਖੁਰਾਕ ਸੁਰੱਖਿਆ ਨੀਤੀ ਨੇ ਰਾਜ ਦੇ ਖੇਤੀਬਾੜੀ ਦੇ ਪੈਟਰਨ ਵਿੱਚ ਇੱਕ ਵੱਡੀ ਤਬਦੀਲੀ ਕਰਨ ਤੋਂ ਤੁਰੰਤ ਬਾਅਦ ਵਪਾਰੀ ਇੱਕ ਵਧੇਰੇ ਨਿਰਬਲਤਾ ਹਨ ਕਣਕ ਝੋਨੇ ਦੇ ਫ਼ਸਲੀ ਚੱਕਰ ਅਤੇ ਪਾਣੀ ਅਤੇ ਖਾਦਾਂ ਦੀ ਤੀਬਰ ਵਰਤੋਂ ਨਾਲ ਜੁੜਿਆ ਹੋਇਆ ਹੈ